ਸਾਡੇ ਇੱਥੇ ਨਵਾਂ ਸ਼ਹਿਰ ਵਿੱਚ ਬਹੁਤ ਹੀ ਜ਼ਿਆਦੇ ਟੈਕਸੀ ਸਟੈਂਡ ਹਨ ਜੋ ਕਿ ਸ਼ਾਮ ਏਜੰਸੀ ਰਮਨ ਏਜੰਸੀ ਸੁਰਜੀਤ ਏਜੰਸੀ ਟਰੈਵਲ ਇਹਨਾਂ ਕੋਲ ਸਾਰੇ ਹੀ ਮਿਲ ਜਾਂਦੀਆਂ ਗੱਡੀਆਂ ਛੋਟੀਆਂ ਵੱਡੀਆਂ ਵੱਡੀਆਂ ਟਰੈਵਲ ਛੋਟੀਆਂ ਕਾਰਾਂ ਵੱਡੀਆਂ ਕਾਰਾਂ ਜਿਸ ਹਿਸਾਬ ਨਾਲ਼ ਜਿੱਦਾਂ ਦੀ ਸਵਾਰੀ ਹੋਵੇ ਉਸ ਹਿਸਾਬ ਨਾਲ ਆਪਾਂ ਲੋਂਗ ਟੂਰ 'ਤੇ ਜਾਣਾ ਹੋਵੇ ਸਫਰ 'ਤੇ ਜਾਣਾ ਹੋਵੇ ਜੋ ਕਿ ਸਾਨੂੰ ਆਸਾਨੀ ਨਾਲ ਹੀ ਮਿਲ ਜਾਂਦੀਆਂ ਹਨ ਜਿੱਦਾਂ ਕਿ ਲੇਟਸਟ ਹੀ ਮੇਰੇ ਪਰਿਵਾਰ ਨੇ ਟਰੈਵਲ ਕੀਤਾ ਹੈ ਜੋ ਕਿ ਪੰਦਰ੍ਹਾਂ ਦਿਨ ਦਾ ਹੀ ਟੂਰ ਸੀ ਅਸੀਂ ਟਰੈਵਲਰ ਬੁੱਕ ਕੀਤੀ ਸੀ ਟਰੈਵਲ ਟੈਂਪੂ ਜੋ ਕਿ ਅਸੀਂ ਕਿਹਾ ਸੀ ਹਿਮਾਚਲ ਪ੍ਰਦੇਸ਼ ਘੁੰਮਣਾ ਏ ਆ ਹਰੇਕ ਦੇਵੀ ਦਰਸ਼ਨ ਕਰਨੇ ਆ ਉਧਰ ਜੰਮੂ ਕਸ਼ਮੀਰ ਹਰੇਕ ਪਾਸੇ ਸੀਗਾ ਘੁੰਮ ਕੇ ਆਣਾ ਏ ਆ ਅਤੇ ਸਾਨੂੰ ਉਸ ਆਪਣੇ ਉਹਨੇ ਰੇਟ ਦੱਸੇ ਵੀ ਅਸੀਂ ਇੰਨਾ ਘੁੰਮਣਾ ਜੋ ਕਿ ਸਾਨੂੰ ਬਹੁਤ ਹੀ ਜ਼ਿਆਦਾ ਫਾਇਦਾ ਹੋਇਆ ਸਾਨੂੰ ਕੋਈ ਵੀ ਦਿੱਕਤ ਨਹੀਂ ਆਈ ਏਜੰਸੀ ਤੋਂ ਉਨ੍ਹਾਂ ਨੇ ਉਹ ਡਰਾਈਵਰ ਵੀ ਬਹੁਤ ਵਧੀਆ ਬੋਲ ਬਾਣੀ ਰੱਖੀ ਬਹੁਤ ਵਧੀਆ ਵਰਤਿਆ ਅਤੇ ਅਸੀਂ ਜਿੰਨਾ ਦਿਨ ਚਾਹੇ ਅਸੀਂ ਪੰਦਰ੍ਹਾਂ ਦਿਨ ਆਰਾਮ ਨਾਲ ਘੁੰਮ ਘੁੰਮ ਫਿਰ ਕੇ ਪੂਰਾ ਇੰਨਜੁਇਮੈਂਟ ਕਰਕੇ ਅਸੀਂ ਘਰ 'ਚ ਵਾਪਸੀ ਕੀਤੀ ਆ ਬਟ ਜੇ ਆਪਾਂ ਉੱਦਾਂ ਏਜੰਸੀ ਵਿੱਚੋਂ ਏਜੰਟਾਂ ਬਾਰੇ ਗੱਲ ਕੀਤੀ ਜਾਵੇ ਤਾਂ ਸਾਡੀ ਇਸ ਇਲਾਕੇ ਵਿੱਚ ਬਹੁਤ ਹੀ ਵਧੀਆ ਏਜੰਟ ਹਨ ਅਤੇ ਏਜੰਸੀ ਹਨ ਜੋ ਕਿ ਆਪਣੇ ਕਲਾਇੰਟ ਨਾਲ਼ ਵਧੀਆ ਡੀਲ ਕਰਦੇ ਹਨ ਸੋ ਅਸੀਂ ਇਹ ਹੀ ਅਪੀਲ ਕਰਾਂਗੇ ਵੀ ਅਗਾਹਾਂ ਵਾਸਤੇ ਵੀ ਸਾਨੂੰ ਕਦੇ ਲੋੜ ਪਵੇ ਅਸੀਂ ਆਪਣਾ ਇੱਥੇ ਹੀ ਬੁੱਕ ਕਰਕੇ ਅਗਾਹਾਂ ਜਾਵਾਂਗੇ ਸਾਨੂੰ ਕੋਈ ਵੀ ਦਿੱਕਤ ਨਹੀਂ ਆਈ ਅਸੀਂ ਜਿੱਥੇ ਵੀ ਇਹ ਏਜੰਸੀਆਂ ਜਿੱਥੇ ਮਰਜ਼ੀ ਔਲ ਇੰਡੀਆ ਟਰੈਵਲ ਕਰਦੀ ਆ ਜਿੱਥੇ ਵੀ ਚਾਹੇ ਸਾਡੇ ਇੱਥੇ ਬੱਸਾਂ ਵੀ ਹਨ ਬੱਸਾਂ ਵੀ ਜਾਂਦੀਆਂ ਰੇਲਗੱਡੀਆਂ ਵੀ ਜਾਂਦੀਆਂ ਹਨ ਬਟ ਸਾਨੂੰ ਐਰੋਪਲੇਨ ਸਭ ਕੁਝ ਜੈਟ ਬੁਕ ਵੀ ਕੀਤੇ ਜਾਂਦੇ ਹਨ ਅਤੇ ਸਾਨੂੰ ਪਰ ਇਹਨਾਂ ਦਾ ਬਹੁਤ ਫਾਇਦਾ ਏ ਆ ਏਜੰਸੀ ਦਾ ਕਿਉਂਕਿ ਸਾਡੇ ਲੋਕਲ ਸਾਡੇ ਲੋਕਲ 'ਚ ਹੈਗੀਆਂ ਇਹ ਅਸੀਂ ਨੇੜੇ ਵਾਲ਼ਾ ਘੱਟ ਰੇਟ ਵਿੱਚ ਵੀ ਲੈ ਕੇ ਜਾਂਦੇ ਬੰਦੇ ਨੂੰ ਅਤੇ ਬਹੁਤ ਵਧੀਆ ਹੀ ਮਤਲਬ ਕਿ ਗੱਡੀ ਬਹੁਤ ਵਧੀਆ ਹਨ ਕੋਈ ਖਰਾਬੀ ਵੀ ਨਹੀਂ ਆਉਂਦੀ ਕੋਈ ਦਿੱਕਤ ਨਹੀਂ ਆਉਂਦੀ